ਸਤਿ ਸ਼੍ਰੀ ਅਕਾਲ ਭਾਈ ਕੌਣ ਬੋਲਦਾ ਹਾਂਜੀ ਹਾਂਜੀ ਗੁਰਮੁਖ ਸਿਆਂ ਕੀ ਹਾਲ ਆ ਹਾਂਜੀ ਕਿਹੜੀ ਦੇਖ ਲਈ ਮੇਰੀ ਵੀਡੀਓ ਹਾਂ ਹਾਂ ਹਾਂ ਗੁੜ ਬਣਾਇਆ ਕਲਾੜ ਲਾਇਆ ਅਸੀਂ ਦੋ ਪਿਛਲੇ ਦੋ ਤਿੰਨ ਸਾਲਾਂ ਤੋਂ ਚੱਲ ਰਿਹਾ ਆਪਣਾ ਵਧੀਆ ਕੰਮ

ਹਾਂ ਹਾਂ ਔਰਗੈਨਿਕ ਬਿਨਾਂ ਕੈਮੀਕਲ ਤੋਂ ਅਸੀਂ ਤਾਂ ਰਿਓ ਵੀ ਬਹੁਤ ਥੋੜ੍ਹਾ ਪਾਉਂਦੇ ਹਾਂ ਗੰਨੇ 'ਚ

ਦੇਖੋ ਜ਼ਿਆਦਾ ਤਾਂ ਆਉਣਾ ਹੀ ਪਊ ਜੇ ਨੇੜੇ ਆ ਤਾਂ ਫੜ੍ਹਾ ਵੀ ਦੇਵਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਹਾਂ ਹਾਂ ਹਾਂ ਹੁੰਦਾ ਹੀ ਆ ਇੰਨਾ ਕੁ ਤਾਂ ਕਿੰਨਾ ਕੁ ਲੈਣਾ ਤੁਸੀਂ ਵੀਰੇ ਬਾਈ ਇੰਨਾ ਕੁ ਤਾਂ ਇੰਨਾ ਕੁ ਤਾਂ ਤਿਆਰ ਪਿਆ ਹੁੰਦਾ ਮੈਂ ਕਿਹਾ ਕਿਤੇ ਕੋਈ ਵੱਡਾ ਓਡਰ ਆ ਆ ਚੈੱਕ ਕਰ ਲਓ ਕਰ ਲਓ ਵਧੀਆ ਗੱਲ ਆ ਸਿਆਣੀ ਗੱਲ ਆ ਭਾਈ ਬਸ ਬਸ ਵਧੀਆ ਦੱਸੋ ਕੈਮੀਕਲ ਤੋਂ ਬਿਨਾਂ ਨਾਲ ਤਿਆਰ ਕਰ ਦਾਂਗੇ ਆਪਾਂ ਦੇਖੋ ਤੁਸੀਂ ਆਓ ਤਾਂ ਸਹੀ ਰੇਟ ਵੀ ਕਰ ਲਾਂਗੇ ਕੋਈ ਨਾ ਆਪਾਂ ਕਹਿ ਦੇਣਾ ਜਵਾਕਾਂ ਨੂੰ ਭੇਜ ਦੇਣਗੇ ਤੈਨੂੰ ਵਟਸਐਪ 'ਤੇ ਹਾਂ ਆ ਜਾਓ ਆ ਜਾਓ ਜਦੋਂ ਮਰਜ਼ੀ ਆ ਜਾਓ ਜੀ ਆਪਣਾ ਘਰ ਦੇ ਕੋਲ ਆ ਖੇਤ 'ਚ ਹੀ ਆ ਘਰ ਤਾਜ਼ਾ ਤਾਜ਼ਾ ਜੀ ਹੁਣ ਤਾਂ ਆਪਣਾ ਸੀਜ਼ਨ ਚੱਲਦਾ ਨਾ ਆਹ ਇਹ ਹੈਗਾ ਆਪਣਾ ਮਾਰਚ ਦੇ ਸ਼ੁਰੂ ਤੱਕ ਉਦੋਂ ਤੱਕ ਤਾਂ ਜਿਹੋ ਜਿਹਾ ਮਰਜ਼ੀ ਲੈ ਜਾਓ ਚਾਹੇ ਤੁਸੀਂ ਹਾਂ ਗਰਮ ਵੀ ਤੁਹਾਨੂੰ ਘੁਲਾੜ ਦਾ ਵੀ ਦੇ ਦਿਆਂਗੇ ਸ਼ੱਕਰ ਵੀ ਬਣੀ ਹੁੰਦੀ ਹਾਂ ਆਪਣੇ ਕੋਲ ਸਰੋਂ ਦਾ ਤੇਲ ਵੀ ਹੁੰਦਾ

ਆਪਣਾ ਆਪਣਾ ਜੀ ਆਪਣੇ ਕੋਲ ਆਪਣਾ ਸੈਲਰ ਵੀ ਹੈਗੇ ਨੇ ਤੇਲ ਆਪਾਂ ਥੋੜ੍ਹਾ ਜਿਹਾ ਮਾਰਕਿਟ 'ਚ ਵੀ ਦਿੰਦੇ ਹਾਂ ਪੈਕਿੰਗ ਤੁਸੀਂ ਕੋਲ ਖੜ੍ਹ ਕੇ ਕਢਾ ਵੀ ਸਕਦੇ ਹੋ ਉਹ ਵੀ ਤੁਹਾਨੂੰ ਦੱਸ ਦਿਆਂਗੇ ਆ ਜਿਓ ਜੀ ਕੋਈ ਨਾ ਉਹ ਹਿਸਾਬ ਹੁੰਦਾ ਨਹੀਂ ਨਹੀਂ ਐਂ ਹੁੰਦਾ ਨਾ ਵੀ ਕਿੰਨਾ ਕੁ ਲੈਣਾ ਜੀ ਮਾੜੇ ਮੋਟੇ 'ਚ ਹੁਣ ਪੜਤਾ ਨਹੀਂ ਨਾ ਪੈਂਦਾ ਜਿਹੋ ਜਿਹਾ ਲੈਣਾ ਉਹੋ ਜਿਹੇ ਚਲੋ ਦਸ ਰੁਪਈਏ ਇੱਧਰ ਕਰ ਲਾਂਗੇ ਕੋਈ ਕੋਈ ਨਾ ਕੋਈ ਨਾ ਜੀ ਤੁਸੀਂ ਆ ਜਿਓ ਰੇਟ ਵੀ ਕਰ ਲਾਂਗੇ ਖੁੱਲ੍ਹਾ ਵੀ ਜਿਵੇਂ ਮਰਜ਼ੀ ਤੁਸੀਂ ਪੈਕਿੰਗ ਵੀ ਆਉਂਦੀ ਆ ਪੈਕਿੰਗ 'ਚ ਐਂ ਵੀ ਥੋੜ੍ਹਾ ਜਿਹਾ ਉਹ ਪੈਕਿੰਗ ਦਾ ਬਣ ਜਾਂਦਾ ਬਸ ਕੁ ਕੋਈ ਨਾ ਕੋਈ ਨਾ ਤੁਸੀਂ ਇਕੱਠੇ 'ਚ ਫਿਰ ਹੋਰ ਕਰ ਦਾਂਗੇ ਤੁਹਾਨੂੰ ਕੋਈ ਨਾ ਰੈਤ

ਅਜੇ ਤਾਂ ਦੇਖੋ ਸ਼ੁਰੂਆਤ ਆ ਇਹ ਕੰਮਾਂ ਦੀ ਸ਼ੁਰੂ ਕਰਦੇ ਹਾਂ ਫਿਰ ਹੋਰ ਨਾਲ ਜੋੜਾਂਗੇ ਹਾਂ ਜਣੀ

ਹਾਂ ਕੋਈ ਨਾ ਕੋਈ ਤੇਲ ਵੀ ਆਪਣਾ ਕੱਢਿਆ ਵੀ ਪਿਆ ਜੇ ਕਢਾਉਣੀ ਹੋਈ ਘਾਣੀ ਇੱਕ ਕੱਢ ਵੀ ਦੇਵਾਂਗੇ ਤੁਹਾਨੂੰ

ਬਾ ਕੋਈ ਨਾ ਕੋਈ ਨਾ ਤੁਸੀਂ ਫੋਨ ਕਰ ਲਿਓ ਉੱਥੋਂ ਆ ਕੇ ਲੈ ਵੀ ਜਾਵਾਂਗੇ ਜੇ ਨਾ ਸਮਝ ਲੱਗਿਆ ਤੁਹਾਨੂੰ ਵੀ ਮੈਂ ਪੁੱਛ ਲੈਂਦਾ ਕਰ ਦੇਣਗੇ ਨਹੀਂ ਮੇਰਾ ਨੰਬਰ ਹੈਗਾ ਮੈਂ ਜਦੋਂ ਕਹੋਂਗੇ ਉਦੋਂ ਹੀ ਆ ਕੇ ਤੁਹਾਨੂੰ ਲੈ ਜੂ ਉੱਥੋਂ ਫਿਰਨੀ ਤੋਂ ਵਾਹ ਜੀ ਠੀਕ ਆ ਜੀ ਠੀਕ ਆ ਓਕੇ ਭਾਅ ਜੀ ਸਤਿ ਸ਼੍ਰੀ ਅਕਾਲ